ਸਾਡੇ ਧਾਰਮਿਕ ਅਭਿਆਸ ਨਾਲ ਸੰਗਤ ਕਈ ਤਰ੍ਹਾਂ ਦੇ ਗੀਤ ਹਨ ਮੈਂ ਖੁਦ ਵੀ ਕਈ ਧਾਰਮਿਕ ਗੀਤ ਲਿਖੇ ਹਨ ਮਨ ਧਾਰ ਧਾਰਮਿਕ ਗੀਤ ਗਾਉਣ ਦਾ ਬਹੁਤ ਸ਼ੌਂਕ ਹੈ ਮੈਂ ਕਈ ਧਾਰਮਿਕ ਗੀਤ ਵੀ ਗਾਏ ਹਨ ਮੈਨੂੰ ਕਈ ਦੇ ਗਾਣੇ ਹੋਣੇ ਧਾਰਮਿਕ ਗੀਤ ਪਸੰਦ ਹਨ ਉਹਨਾਂ ਵਿੱਚੋਂ ਗੁਰਦਾਸ ਮਾਨ ਜੀ ਦੇ ਗੀਤ ਮੈਂ ਬਹੁਤ ਪਸੰਦ ਕਰਦਾ ਹਾਂ ਜਿਵੇਂ ਕਿ ਸਬੰਧ ਦਾਨੀਆ ਵੀ ਤੇਰਾ ਕੌਣ ਗਾਇਓ ਦੇਣਾ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਬਾਰੇ ਜ਼ਿਕਰ ਕੀਤਾ ਹੈ